ਹੈਲੋ ਹਾਂਜੀ ਤੁਸੀਂ ਬਸੰਤ ਕੈਟਰਿੰਗ ਤੋਂ ਬੋਲਦੇ ਪਏ ਅੱਛਾ ਮੇਰੀ ਨਾ ਫਰੈਂਡ ਨੇ ਨੰਬਰ ਦਿੱਤਾ ਸੀ ਤੁਹਾਡਾ ਮੈਨੂੰ ਨਾ ਕੈਟਰਿੰਗ ਬਾਰੇ ਪੁੱਛਣਾ ਸੀ ਤੁਹਾਡੀ ਪਰਸੋਂ ਨਾ ਮੇਰੇ ਘਰ ਪਰਸੋਂ ਨਾ ਮੇਰੇ ਘਰ ਵੈਡਿੰਗ ਹੈ ਮੈਨੂੰ ਲੰਚ ਲੰਚ ਬਾਰੇ ਪੁੱਛਣਾ ਸੀ ਤੁਹਾਡੇ ਲੰਚ ਵਿੱਚ ਕੀ ਕੀ ਆਈਟਮ ਹੈ ਹਾਂਜੀ ਹਾਂਜੀ ਹਾਂਜੀ ਅੱਛਾ ਐਚੂਅਲੀ ਨਾ ਮੈਨੂੰ ਨਾ ਵ ਕਿਆ ਕਹਿੰਦਾ ਨਾ ਫੂਡ ਨਾ ਬਿਲਕੁਲ ਸਹੀ ਮਤਲਬ ਚੰਗਾ ਚਾਹੀਦਾ ਹੈ ਕਿਉਂਕਿ ਪਿਛਲੀ ਵਾਰ ਮੈਂ ਜਿ ਜਿਸ ਤੋਂ ਕਰਾਇਆ ਸੀ ਨਾ ਉਹਦੇ ਬਹੁਤ ਹੀ ਮਤਲਬ ਖਰਾਬ ਖਾਣਾ ਦਿੱਤਾ ਸੀ ਮੇਰੇ ਪੈਸੇ ਵੀ ਵੇਸ ਅਤੇ ਮੈਨੂੰ ਸਾਰੇ ਲੋਕ ਬੋਲਦੇ ਸੀ ਕਿ ਕਿੱਦਾਂ ਦਾ ਖਾਣਾ ਬਣਵਾਇਆ ਕਿੱਦਾਂ ਦਾ ਖਾਣਾ ਸੋ ਪਲੀਜ਼ ਤੁਸੀਂ ਖਾਣਾ ਮੈਨੂੰ ਚੰਗਾ ਮਤਲਬ ਅਰੇਂਜ ਕਰ ਕੇ ਦਿਓ ਔਰ ਪ ਪਰ ਪਲੇਟ ਤੁਹਾਡਾ ਕੀ ਹੈ ਸਿਸਟਮ ਅੱਛਾ ਸਾਡੇ ਗੈਸਟ ਸਾਡੇ ਗੈਸਟ ਨਾ ਦੋ ਸੌ ਹੈ ਹਾਂਜੀ ਦੋ ਸੌ ਗੈਸਟ ਹੈ ਤੋਂ ਪਰਸੋਂ ਸਾਡਾ ਲੰਚ ਦਾ ਪਰਸੋਂ ਨਾ ਸਾਡੇ ਘਰ ਵੈਡਿੰਗ ਲੰਚ ਮਤਲਬ ਵੈਡਿੰਗ ਹੈ ਪਰ ਸਾਨੂੰ ਦੁਪਹਿਰ ਦਾ ਲੰਚ ਹੈ ਨਾ ਉਹ ਚਾਹੀਦਾ ਤੁਸੀਂ ਪਲੀਜ਼ ਪਰੋਪਰ ਅਰੇਂਜਮੈਂਟ ਕਰਿਓ ਤਾਂ ਕਿ ਮਤਲਬ ਸਾਨੂੰ ਨਾ ਸ਼ਿਕਾਇਤ ਦਾ ਕੋਈ ਮੌਕਾ ਨਾ ਮਿਲੇ ਠੀਕ ਹੈ ਨਾ ਠੀਕੇ ਮੈਂ ਨਾ ਤੁਹਾਨੂੰ ਨਾ ਨੰਬ ਮਤਲਬ ਮੈਸਜ਼ ਮਤਲਬ ਵਟਸਐਪ 'ਤੇ ਨਾ ਆਪਣਾ ਐਡਰੈੱਸ ਸੈਂਡ ਕਰਦੂਂਗੀ ਤੁਸੀਂ ਨਾ ਮੈਨੂੰ ਨਾ ਪਰਸੋਂ ਲੰਚ ਮਤਲਬ ਉਹ ਕਰਾ ਦਿਓ ਚੰਗੀ ਤਰ੍ਹਾਂ ਪਰੀਪੇਅਰ ਕਰਵਾ ਕੇ ਭੇਜ ਦਿਓ ਮੈਂ ਐਡਰੈੱਸ ਤੁਹਾਨੂੰ ਸੈਂਡ ਕਰਦੂਂਗੀ ਠੀਕ ਹੈ ਠੀਕ ਹੈ ਓਕੇ ਥੈਂਕ ਯੂ ਓਕੇ ਓਕੇ